ਹੈਲੋ ਹੈਲੋ ਵਧੀਆ ਜੀ ਜੀ ਨਹੀਂ ਜੀ ਕੌਣ ਅੱਛਾ ਅੱਛਾ ਠੀਕ ਆ ਉਹ ਹੀ ਜਿਹੜਾ ਆਹ ਗਾਣੇ ਗਾਉਣ ਵਾਲਾ ਅੱਛਾ ਜੀ ਪਛਾਣ ਤਾਂ ਪੁੱਤ ਮੈਂ ਪਹਿਲਾਂ ਹੀ ਲੈਣਾ ਸੀ ਆਓ ਪਹਿਛਾਣ ਤਾਂ ਮੈਂ ਤਾਂ ਮੈਖਾਂ ਪਹਿਲਾਂ ਹੀ ਲਿਆ ਸੀ ਹਾਂ ਥੋੜ੍ਹੇ ਗਾਣੇ ਤੇਰੇ ਘੱਟ ਸੁਣਦਾ ਮੈਂ ਉਹ ਗੱਲ ਨੀ ਪੁੱਤ ਉਹ ਥੋੜ੍ਹੇ ਤੇਰੇ ਗਾਣੇ ਉਹ ਨੇ ਹਾਂ ਕੁੜੀਆਂ ਵਾਲੇ ਹੀ ਨੇ ਤਾਂ ਹੀ ਨਹੀਂ ਸੁਣਦੇ ਔਰ ਯਾਦ ਕਿਓਂ ਰੋਲ ਫਿਲਮਾਂ 'ਚ ਕਿ ਗਾਣੇ 'ਚ ਫਿਲਮ ਤਾਂ ਅਜੇ ਦੇਖਾਂਗੇ ਅਸੀਂ ਤਿੰਨ ਕੁ ਮਹੀਨੇ ਤੱਕ ਤਿੰਨ ਕੁ ਮਹੀਨੇ ਤੱਕ ਫਿਲਮ 'ਚ ਰੋਲ ਆਊਗਾ ਗਾਣਾ ਹਾਂਜੀ ਉਹ ਵਾਲੀ ਜਿਊਣਾਂ ਮੋੜ ਜੀਪ 'ਤੇ ਫਰਾਰ ਹੋ ਗਿਆ ਹਾਂਜੀ ਅਤੇ ਗਾਣਾ ਪਿੱਛੇ ਬੰਦੂਕ ਦੇ ਕੇ ਪੜਾ ਖੜਾਵਾਂਗੇ ਹਾਂਜੀ ਫਿਰ ਤੁਹਾਨੂੰ ਮੇਨ ਹੀਰੋ ਦਾ ਹੀ ਦਵਾਉਣਾ ਪੈਣਾ ਹੀਰੋ ਦਾ ਫਿਰ ਐਂ ਆ ਥੋੜ੍ਹਾ ਜਿਹਾ ਹੱਟਾ ਕੱਟਾ ਬੰਦਾ ਚਾਹੀਦਾ ਵਾ ਤੁਹਾਨੂੰ ਜਿਮ ਲਾਉਣੀ ਪੈਣੀ ਆ ਫਿਰ ਪਤਲੇ ਤਾਂ ਪਤਲੇ ਤਾਂ ਹੋਏ ਪਏ ਓਂ ਤਾਂ ਕਹਿੰਦਾਂ ਸੀ ਮੈਂ ਤਾਂ ਹਾਂਜੀ ਤਿੰਨ ਮਹੀਨਿਆਂ ਦਾ ਟਾਈਮ ਹੈਗਾ ਵਾ ਫਿਰ ਬਾਕੀ ਬਾਅਦ 'ਚੋਂ ਸੋਚਾਂਗੇ ਹੀਰੋ ਦਾ ਉਹ ਹੀ ਹੈ ਜੀ ਆਹਾ ਥੋੜ੍ਹਾ ਜਿਹਾ ਕੁੱਟਮਾਰ ਵਾਲਾ ਵਾ ਹਾਂਜੀ ਹਾਂਜੀ ਗੁੰਡਾ ਟੱਚ ਗੁੰਡਾ ਟੱਚ ਐਕਟਰਸ ਆਪਾਂ ਦੇਖਦੇ ਹਾਂ ਜੀ ਸੋਨਮ ਬਾਜਵਾ ਹੀ ਪਊਗੀ ਜੀ ਫੀਸ ਤਾਂ ਹਲੇ ਦੇਖਲਾਂਗੇ ਜੇ ਸਾਨੂੰ ਰੋਲ ਵਧੀਆ ਲੱਗਿਆ ਤਾਂ ਹਾਂਜੀ ਔਰ ਤੁਸੀਂ ਦੱਸ ਦਿਓ ਐਕਟਰਸ ਕਿਹੜੀ ਲੈਣੀ ਆ ਹੈਲਪ ਫਿਰ ਤੁਹਾਨੂੰ ਉਹਦਾ ਦਵਾ ਦਿੰਦੇ ਹਾਂ ਜਿਹੜੇ ਉਹਦੇ ਨਾਲ ਹੁੰਦੇ ਨੇ ਹਾਂ ਹੀਰੋ ਦੇ ਨਾਲ ਵਾਲੇ ਹਾ ਹਾਂਜੀ ਚੁੱਕ ਕੇ ਫਿਰ ਤੁਸੀਂ ਛੱਡ ਆਓਗੇ ਹਾਂਜੀ ਬਾਈ ਸੋਚ ਤਾਂ ਤੁਹਾਡੀ ਵਧੀਆ ਮੈਂ ਤਾਂ ਇੱਥੋਂ ਹੀ ਮੋਹਿਤ ਹੋ ਗਿਆ ਹਾਂਜੀ ਮੈਂ ਤਾਂ ਸੋਚਦਾ ਸੀਗਾ ਵੀ ਗਾਣੇ ਤੁਸੀਂ ਇਹੋ ਜਿਹੇ ਗਾਉਂਦੇ ਓਂ ਵੀ ਤੁਸੀਂ ਅਸਲ 'ਚ ਵੀ ਇਹੋ ਜਿਹੇ ਹੀ ਹੋਵੋਗੇ ਇਹ ਤਾਂ ਗੱਲ ਹੈਗੀ ਹੈ ਜੀ ਹੁਣ ਅਸੀਂ ਜੇ ਦੂਜੀਆਂ ਫਿਲਮਾਂ ਕਰਦੇ ਹਾਂ ਲੋਕ ਸਾਨੂੰ ਐਂ ਕਹਿੰਦੇ ਵੀ ਤੁਸੀਂ ਤਾਂ ਗੁੰਡੇ ਓਂ ਹਾਂਜੀ ਮੈਂ ਚੰਡੀਗੜ੍ਹ ਬੈਠਾ ਜੀ ਚੰਡੀਗੜ੍ਹ ਦੇ ਲਾਗੇ ਬੈਠਾ ਸੀ ਮੈਂ ਹਾਂਜੀ ਪੱਕਾ ਹੀ ਆ ਜੀ ਕਿੱਥੇ ਓ ਤੁਸੀਂ ਪਿੰਡ ਕਿਹੜਾ ਤੁਹਾਡਾ ਅੱਛਾ ਜੀ ਮੇਰਾ ਵੀ ਮੇਨ ਓਫਿਸ ਉੱਥੇ ਹੀ ਆ ਲੁਧਿਆਣੇ ਜੀ ਐਨ ਏ ਦੇ ਨਾਲ ਹਾਂਜੀ ਰੋਇਲ ਪਲੇਸ ਦੇਖੀ ਆ ਤੁਸੀਂ ਜੀ ਨਾਮ ਆ ਰੋਇਲ ਪਲੇ ਉਹ ਅਤੇ ਹਾਂਜੀ ਸੱਤਵੇਂ ਫਲੋਰ ਦੇ ਉੱਤੇ ਆ ਤੁਸੀਂਹੈ ਕਰਿਓ ਅਗਲੇ ਹਫ਼ਤੇ ਬੁੱਧਵਾਰ ਨੂੰ ਆ ਜਾਓ ਮੇਰੇ ਕੋਲ ਹਾਂਜੀ ਤੁਸੀਂ ਵਿਹਲੇ ਹੀ ਹੋ ਅੱਛਾ ਮਾਰਿਓ ਮਾਰਿਓ ਗੇੜਾ ਕੋਈ ਨਹੀਂ ਕਰਾਂਗੇ ਆਪਾਂ ਬਹਿ ਕੇ ਵਿਚਾਰ ਆਪਾਂ ਆਪਣੇ ਸਾਂਝੇ ਕਰਾਂਗੇ ਠੀਕ ਹੈ ਜੀ ਓਕੇ ਸਤਿ ਸ਼੍ਰੀ ਅਕਾਲ